ਹਾਂ ਗਣਿਤ ਅਤੇ ਵਿਗਿਆਨ ਮੇਰੀ ਬੇਟੀ ਦੇ ਨਾਨ ਮੈਡੀਕਲ ਪਲੱਸ ਵੰਨ ਪਲੱਸ ਟੂ ਦੇ ਵਿੱਚ ਨਾਨ ਮੈਡੀਕਲ ਨਾਲ ਜੋ ਕੀਤੀ ਆ ਉਸ ਵਿੱਚ ਗਣਿਤ ਅਤੇ ਵਿਗਿਆਨ ਜ਼ਰੂਰੀ ਹੁੰਦੇ ਸੀਗੇ ਉਹਨਾਂ ਜਾਣਕਾਰੀ ਵਿੱਚ ਵਾਧਾ ਕਰਨ ਲਈ ਉਸਨੇ ਸਕੂਲ ਵਿੱਚ ਵਾਧੂ ਕਲਾਸਾਂ ਵੀ ਲਾਈਆਂ ਅਤੇ ਉਸ ਦੀ ਟਿਊਸ਼ਨ ਵੀ ਰੱਖੀ ਕਿਉਂਕਿ ਪਿੰਡਾਂ ਦੇ ਬੱਚੇ ਹੋਣ ਕਰਕੇ ਟਿਊਸ਼ਨ ਦੀ ਜ਼ਰੂਰਤ ਪੈਂਦੀ ਸੀ ਉਸਨੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਟਿਊਸ਼ਨਾਂ ਜ਼ਰੂਰ ਲਈਆਂ ਪਰ ਇਹ ਕੋਰਸ ਜਿਵੇਂ ਕਿ ਇੱਥੇ ਪੁੱਛਿਆ ਗਿਆ ਵੀ ਕਿੰਨੇ ਔਖੇ ਨੇ ਔਖੇ ਬਿਲਕੁਲ ਨਹੀਂ ਔਖੀ ਉਹ ਚੀਜ਼ ਹੁੰਦੀ ਆ ਜੋ ਨਾ ਸ ਹੋ ਸਕਣ ਯੋਗ ਯੋਗ ਹੋਵੇ ਜੋ ਹੋ ਸਕਣ ਯੋਗ ਹੋਵੇ ਉਹ ਕੋਈ ਔਖੀ ਨਹੀਂ ਹੁੰਦੀ ਹਾਂ ਇਹ ਜ਼ਰੂਰ ਆ ਵੀ ਜਿੱਥੇ ਅੱਧਾ ਘੰਟਾ ਲੱਗਣਾ ਉੱਥੇ ਪੌਣਾ ਘੰਟਾ ਲੱਗ ਜਾਵੇ ਉਸ ਚੀਜ਼ ਨੂੰ ਪਰ ਹੋਊਗੀ ਜ਼ਰੂਰ ਪਰ ਉਹ ਆਪਾਂ ਔਖਾ ਮੰਨ ਕੇ ਨਾ ਜਾਣੀ ਕਿ ਪੋਜੀਟਿਵ ਸੋਚ ਕੇ ਚੱਲੀਏ ਇਸ ਕਰਕੇ ਕੋਈ ਬੜੀ ਗੱਲ ਨਹੀਂ ਕੋਈ ਔਖੀ ਨਹੀਂ ਠੀਕ ਠਾਕ ਆ ਸਭ